ਦਸ ਦਿਨ ਪਹਿਲਾਂ ਮੈਂ ਆਪਣੀ ਔਨਲਾਈਨ ਸ਼ੋਪਿੰਗ ਕੀਤੀ ਸੀਗੀ ਜਿਹਦੇ ਵਿੱਚ ਮੈਂ ਆਪਣੀ ਮੇਕਅੱਪ ਕਿਟ ਮੰਗਾਈ ਸੀ ਅਤੇ ਜਿਹਦੇ ਵਿੱਚ ਮੈਨੂੰ ਮੈਂ ਔਡਰ ਕੀਤਾ ਸੀ ਮੇਕਅੱਪ ਦਾ ਸਮਾਨ ਜਿਵੇਂ ਕੱਜਲ ਲਿਪਸਟਿਕ ਆਈਲੈਂਨਰ ਆਈ ਸ਼ੈਡੋ ਵਗੈਰਾ ਇਹ ਸਭ ਕੁਛ ਔਡਰ ਕੀਤਾ ਸੀ ਅਤੇ ਹੋਰ ਵੀ ਕ੍ਰੀਮਸ ਵਗੈਰਾ ਸੀਗੀਆਂ ਅਤੇ ਜਿਹੜੀਆਂ ਕਿ ਅੱਜ ਮੈਂ ਰਿਸੀਵ ਕੀਤੀਆਂ ਹੈ ਇਹਨਾਂ ਵਿੱਚ ਪਹਿਲਾਂ ਜਦੋਂ ਮੈਂ ਰਿਸੀਵ ਕੀਤਾ ਆਪਣਾ ਔਡਰ ਖੋਲ੍ਹਿਆ ਜਿਹਦੇ ਵਿੱਚ ਮੈਨੂੰ ਇਹਨਾਂ ਦੀ ਪੈਕਿੰਗ ਵੀ ਬਹੁਤ ਵਧੀਆ ਲੱਗੀ ਕਿਉਂਕਿ ਇਹਨਾਂ ਨੇ ਅਪ ਜਿਹੜੇ ਮੇਰੀ ਉਹ ਸੀਗੀ ਕਿੱਟ ਉਹਨਾਂ ਨੂੰ ਬਹੁਤ ਵਧੀਆ ਪੈਕ ਕੀਤਾ ਸੀਗੀ ਕਿ ਜਿਹੜੀਆਂ ਅੰਦਰ ਕੱਚ ਦੀਆਂ ਬੋਟਲ ਸੀਗੀਆਂ ਉਹ ਖਰਾਬ ਹੋਣ ਤੋਂ ਬਚ ਗਈਆਂ ਕਿਉਂਕਿ ਕਈ ਹੁੰਦਾ ਹੈ ਕਿ ਹਾਂ ਉਹ ਨਾ ਵਧੀਆ ਨਹੀਂ ਪੈਕਿੰਗ ਕਰਦੇ ਪਰ ਮੈਨੂੰ ਇਹਨਾਂ ਦੀ ਪੈਕਿੰਗ ਬਹੁਤ ਅੱਛੀ ਲੱਗੀ ਅਤੇ ਮੈਂ ਬਾਅਦ ਵਿੱਚ ਜਦੋਂ ਆਪਣਾ ਖੋਲ੍ਹ ਕੇ ਦੇਖਿਆ ਅਤੇ ਮੈਂ ਯੂਸ ਕੀਤਾ ਇਹਨਾਂ ਨੂੰ ਇਹਨਾਂ ਦੇ ਪ੍ਰੋਡਕਟ ਮੈਨੂੰ ਵਧੀਆ ਲੱਗੇ ਕਿਉਂਕਿ ਮੈਂ ਅੱਗੇ ਵੀ ਮਤਲਬ ਕਿ ਐਵੇਂ ਸ਼ੋਪ ਤੋਂ ਲੈਂਦੇ ਹਾਂ ਤਾਂ ਕੱਜਲ ਵਗੈਰਾ ਜ਼ਿਆਦਾਤਰ ਫੈਲ ਹੀ ਜਾਂਦਾ ਹੈ ਅਤੇ ਇਹਨਾਂ ਦੇ ਮੈਂ ਕੱਜਲ ਵਗੈਰਾ ਨੂੰ ਯੂਸ ਕੀਤਾ ਅਤੇ ਉਹ ਵੀ ਨਹੀਂ ਫੈਲੇ ਅਤੇ ਹੋਰ ਵੀ ਜਿਹੜੇ ਲਿਪਸਟਿਕ ਵਗੈਰਾ ਵੀ ਯੂਸ ਕੀਤੀ ਤਾਂ ਉਹ ਵੀ ਮਤਲਬ ਕਿ ਵਧੀਆ ਉਹਨਾਂ ਦੇ ਰਹੇ ਫਿਰ ਮੈਂ ਬਾਅਦ ਵਿੱਚ ਐਵੇਂ ਆਪਣੇ ਮੰਮਾ ਨੂੰ ਦੱਸਿਆ ਉਹਨਾਂ ਨੇ ਵੀ ਯੂਸ ਕਰਕੇ ਦੇਖਿਆ ਅਤੇ ਉਹਨਾਂ ਨੂੰ ਜ਼ਿਆਦਾਤਰ ਇਹਨਾਂ ਦੇ ਸਾਈਡ ਇਫੈਕਟ ਹੋ ਜਾਂਦੇ ਆ ਪਰ ਇਹਨਾਂ ਦੇ ਜਿਹੜੇ ਹੈਗੇ ਆ ਇਹਨਾਂ ਦੇ ਜਿਹੜੇ ਪ੍ਰੋਡਕਟ ਇਹਨਾਂ ਦੇ ਉਹਨਾਂ ਨੂੰ ਕੋਈ ਸਾਈਡ ਇਫੈਕਟ ਨਹੀਂ ਹੋਇਆ ਫਿਰ ਐਵੇਂ ਮੰਮਾ ਨੇ ਆਪਣੀ ਫਰੈਂਡ ਨੂੰ ਵੀ ਦੱਸਿਆ ਅਤੇ ਉਹਨਾਂ ਨੂੰ ਉਹਨਾਂ ਨੇ ਵੀ ਔਡਰ ਕੀਤਾ ਸੀ ਉਹਨਾਂ ਨੂੰ ਵੀ ਇਹਨਾਂ ਨੇ ਬਹੁਤ ਵਧੀਆ ਔਡਰ ਮਤਲਬ ਕਿ ਉਹਨਾਂ ਨੂੰ ਵੀ ਵਧੀਆ ਲੱਗਿਆ ਇਹਨਾਂ ਦੇ ਪ੍ਰੋਡਕਟ